ਮੈਨੂੰ ਇਹ ਕਈ ਥਾਵਾਂ 'ਤੇ ਜਾਣਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਇਹ ਅਤੇ ਮੈਨੂੰ ਤਸਵੀਰਾਂ ਖਿੱਚਣੀਆਂ ਬਹੁਤ ਜ਼ਿਆਦਾ ਪਸੰਦ ਹੈ ਇਹ ਇਸ ਦੇ ਵਿੱਚ ਇਹ ਜਿਵੇਂ ਮੈਨੂੰ ਨਵੀਂ ਨਵੀਂ ਜਗ੍ਹਾ 'ਤੇ ਜਾ ਜਾਣਾ ਇਹ ਬਹੁਤ ਜ਼ਿਆਦਾ ਪਸੰਦ ਹੈ ਜਿਵੇ ਜਿਵੇਂ ਕਿ ਇਹ ਫੋਟੋਗ੍ਰਾਫੀ ਉੱਥੇ ਕਰਨਾ ਬਹੁਤ ਪਸੰਦ ਹੈ ਜਿਹੜੀਆਂ ਜਗ੍ਹਾ ਮਤਲਬ ਇਹ ਜਿੱਦਾਂ ਅੰਮ੍ਰਿਤਸਰ ਹੋ ਗਿਆ ਇਹ ਉੱਥੇ ਜਲ੍ਹਿਆਂ ਵਾਲਾ ਬਾਗ ਹੈ ਉੱਥੇ ਮੈਨੂੰ ਇਹ ਇੱਦਾਂ ਦੀ ਜਗ੍ਹਾ 'ਤੇ ਮੈਨੂੰ ਫੋਟੋ ਕਲਿੱਕ ਕਰਨ ਦਾ ਬਹੁਤ ਜ਼ਿਆਦਾ ਉਹ ਹੈ ਇਹ ਵਧੀਆ ਲੱਗਦਾ ਬਾਕੀ ਇਹ ਇਕ ਇਹ ਮੇਰੀ ਇਹ ਫੋਟੋਗ੍ਰਾਫੀ ਕਰਨ ਨਾਲ ਮੇਰੀ ਮੈਮਰੀ ਰੀਕੋਲ ਹੋ ਜਾਂਦੀ ਬਾਕੀ ਮੇਰੇ ਕੋਲ ਡਾਟਾ ਜਿੰਨਾ ਵੀ ਹੈ ਇਹ ਸਾਰਾ ਸੇਵ ਰਹਿੰਦਾ ਇਹ ਬਾਕੀ ਇਹ ਫੋਟੋਗ੍ਰਾਫੀ ਕਰਨਾ ਮੈਨੂੰ ਪਸੰਦ ਹੈ ਬਹੁਤ ਜ਼ਿਆਦਾ ਮਤਲਬ ਇਹ ਇਹ ਜਿੱਦਾਂ ਜਿਲ੍ਹਿਆਂ ਵਾਲੇ ਬਾਗ ਵਿੱਚ ਆਪਾ ਜਾ ਕੇ ਉੱਥੇ ਸਾਨੂੰ ਹਿਸਟੋਰੀਕਲ ਪਲੇਸ ਹੈ ਇੱਕ ਪਹਿਲਾ ਤਾਂ ਉਹ ਬਾਕੀ ਉੱਥੇ ਸਾਨੂੰ ਇਹ ਆਪਣੇ ਇਹ ਪੂਰੀ ਹਿਸਟਰੀ ਦਾ ਪਤਾ ਲੱਗਦਾ ਪੂਰੇ ਇਤਿਹਾਸ ਦਾ ਚੱਲਦਾ ਆਪਣਾ ਇਹ ਬਾਕੀ ਇਹ ਫੋਟੋਗ੍ਰਾਫੀ ਕਰਨ ਦੇ ਬਹੁਤ ਜ਼ਿਆਦਾ ਇਹ ਮੇਰਾ ਬਹੁਤ ਜ਼ਿਆਦਾ ਇੱਕ ਵੱਡਾ ਸਪਨਾ ਹੈ ਮੈਂ ਇਹਨੂੰ ਇਹ ਇੰਟਰਨੈਸ਼ਨਲ ਲੈਵਲ 'ਤੇ ਮਤਲਬ ਲੈ ਕੇ ਜਾਵਾਂ ਆਪਣੀ ਫੋਟੋਗ੍ਰਾਫੀ ਨੂੰ ਇਹ ਤਾਂ ਮੇਰਾ ਇਹ ਮਤਲਬ ਮੇਰੇ ਚੰਗੀਆਂ ਤਸਵੀਰਾਂ ਇਹ ਇਹ ਕੈਪਚਰ ਕਰਨ ਨਾਲ ਇਹ ਮੇਰੇ ਬਹੁਤ ਮੈਨੂੰ ਵਧੀਆ ਲੱਗਦਾ